ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿਸੇ ਨੂੰ ਖੁਸ਼ ਕਰਦੀਆਂ ਹਨ ਪਰ ਕੁਝ ਚੀਜ਼ਾਂ ਖਾਸ ਹੁੰਦੀਆਂ ਹਨ ਮੈਨੂੰ ਦੋਸਤਾਂ ਨਾਲ ਘੁੰਮਣਾ ਬਹੁਤ ਪਸੰਦ ਹੈ ਅਤੇ ਇਸ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਹੋਰ ਵੀ ਕਈ ਚੀਜ਼ਾਂ ਹਨ ਜੋ ਮੈਨੂੰ ਖੁਸ਼ ਕਰਦੀਆਂ ਹਨ ਜਿਵੇਂ ਕਿ ਦੋਸਤਾਂ ਨਾਲ ਖੇਡਣਾ ਬਾਈਕ ਰਾਈਡਿੰਗ ਕਰਨਾ ਅਲੱਗ ਅਲੱਗ ਜਗ੍ਹਾਵਾਂ 'ਤੇ ਜਾਣਾ ਅਤੇ ਉਹਨਾਂ ਨੂੰ ਐਕਸਪਲੋਰ ਕਰਨਾ ਕਪਿਲ ਸ਼ਰਮਾ ਦਾ ਸ਼ੋਅ ਦੇਖਣਾ ਸਟੈਂਡਮ ਕਮੇਡੀ ਸੁਣਨਾ ਘਰਦਿਆਂ ਨਾਲ ਗੱਲਾਂ ਕਰਕੇ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਇਵੇਂ ਹੀ ਹੋਰ ਕਈ ਚੀਜ਼ਾਂ ਹਨ ਜੋ ਮੈਨੂੰ ਖੁਸ਼ੀ ਦਿੰਦੀਆਂ ਹਨ